ਹਾਂਜੀ ਹਾਂਜੀ ਹਾਂਜੀ ਹਾਂਜੀ ਮੈਡਮ ਅੱਛਾ ਜੀ ਅੱਛਾ ਜੀ ਹਾਂਜੀ

ਠੀਕ ਹੈ ਜੀ ਠੀਕ ਹੈ ਜੀ ਠੀਕ ਹੈ ਮੈਡਮ ਮੈਂ ਤੁਹਾਨੂੰ ਦੱਸਦਾ ਮੈਮ ਜਿਹੜੇ ਤੁਸੀਂ ਕਹਿੰਦੇ ਬੱਚੇ ਸ਼ਰਾਰਤਾਂ ਕਰਦੇ ਆ ਉਹਨਾਂ ਨੂੰ ਉਹਨਾਂ ਦੇ ਪੇਰੈਂਟਸ ਬੁਲਾਓ ਜਾਂ ਉਹਨਾਂ ਦੇ ਮੋਬਾਈਲ ਨੰਬਰ ਲੈ ਕੇ ਮੈਨੂੰ ਦਿਓ ਫਿਰ ਮੈਂ ਉਹਨਾਂ ਨੂੰ ਕਾਲ ਕਰਕੇ ਉਹਨਾਂ ਨੂੰ ਦੱਸ ਦਿੰਦਾ ਬਾਕੀ ਹੋਰ ਤੁਹਾਡੀ ਕਿਹੜੀ ਪ੍ਰੋਬਲਮ ਆ ਜੀ ਅੱਛਾ ਹਾਂਜੀ ਜਿਹੜੇ ਪ ਠੀਕ ਹੈ ਜੀ ਅੱਛਾ ਜੀ

ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਨਹੀਂ ਡਰੈੱਸ ਕੋਡ ਤਾਂ ਚਲੋ ਉਹ ਤਾਂ ਕਰਲਾਂਗੇ ਤਾਂ ਜੇ ਨਹੀਂ ਜੇ ਪਾ ਕੇ ਆਉਂਦੇ ਡਰੈੱਸ ਕੋਡ ਤਾਂ ਇਹਨਾਂ ਨੂੰ ਜੁਰਮਾਨਾ ਲਾਇਆ ਜਾਵੇ ਹਾਂਜੀ ਠੀਕ ਹੈ ਜੀ ਅੱਛਾ ਜੀ ਹਾਂਜੀ ਕੋਈ ਗੱਲ ਨਹੀਂ ਮੈਂ ਤੁਹਾਡੀ ਪ੍ਰੋਬਲਮ ਸੋਲਵ ਕਰ ਦਿੰਦਾ ਜੀ